ਜਦੋਂ ਕਦੇ ਵੀ ਮੇਰੇ ਕੋਲ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਘੱਟ ਤੋਂ ਘੱਟ ਸਮੱਗਰੀ ਨੂੰ ਵਰਤੋਂ ਕਰਕੇ ਅਤੇ ਚੀਜ਼ਾਂ ਬਣਾ ਲੈਂਦੀ ਹਾਂ ਜਿਸ ਤਰ੍ਹਾਂ ਕਿ ਪਿਆਜ ਅਤੇ ਟਮਾਟਰ ਦੀ ਸਬਜ਼ੀ ਉਹਦੇ ਵਿੱਚ ਥੋੜ੍ਹਾ ਲਸਣ ਅਤੇ ਅਦਰਕ ਪਾ ਕੇ ਅਤੇ ਉਹਦੇ ਵਿੱਚ ਥੋੜ੍ਹੇ ਜੇ ਘਰ 'ਚ ਪਨੀਰ ਹੋਵੇ ਤਾਂ ਪਨੀਰ ਪਾ ਲਈ ਦਾ ਜੇ ਸ਼ਿਮਲਾ ਮਿਰਚ ਹੋਵੇ ਤਾਂ ਉਹ ਪਾ ਕੇ ਉਸ ਟਾਈਮ ਹੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਜੇ ਨਹੀਂ ਹੈ ਕੁਝ ਤਾਂ ਅਦਰਕ ਔਰ ਲਸਣ ਪਿਆਜ ਟਮਾਟਰ ਬਸ ਇਹ ਹੀ ਇਕੱਲਾ ਭੁੰਨ ਕੇ ਇਹਦੀ ਜੇ ਚਾਵਲ ਹੈ ਤਾਂ ਚਾਵਲਾਂ ਦੀ ਪਰੌਂਠੀ ਬਣਾ ਲਈ ਦੀ ਹੈ ਜੇ ਉਹ ਵੀ ਨਾ ਹੋਵੇ ਤਾਂ ਮੈਂ ਪੋਹਾ ਬਣਾਉਣ ਦਾ ਫਿਰ ਮੇਰਾ ਹੁੰਦਾ ਕਿ ਮੈਂ ਪੋਹਾ ਬਣਾ ਲਾ ਜਾਂ ਫਿਰ ਘਰ 'ਚ ਮੁੰਗਰਾ ਪਿਆ ਹੋਵੇ ਤਾਂ ਉਹਦੀ ਸਬਜ਼ੀ ਬਣਾ ਲਵਾਂ ਬਸ ਇਹੋ ਜਿਹੇ ਕੰਮ ਮੈਂ ਜ਼ਿਆਦਾ ਪਸੰਦ ਕਰਦੀ ਹੈ ਕਿ ਘੱਟ ਤੋਂ ਘੱਟ ਸਮੱਗਰੀ ਦੇ ਵਿੱਚ ਮੇਰਾ ਐਟਲੀਸਟ ਮੇਰਾ ਪੇਟ ਭਰ ਸਕੇ